ਹੈਲੋ ਸਵਿਗੀ ਤੋਂ ਬੋਲ ਰਹੇ ਹੋ ਜੀ ਭਾਅ ਜੀ ਮੈਂ ਤੁਹਾਨੂੰ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਕ ਔਡਰ ਬੁੱਕ ਕੀਤਾ ਸੀ ਜਿਹਦੇ ਵਿੱਚ ਮੈਂ ਤੁਹਾਡੀ ਸ਼ੋਪ ਤੋਂ ਕੁਛ ਖਾਣ ਵਾਲੀਆਂ ਚੀਜ਼ਾਂ ਮੰਗਵਾਈਆਂ ਸੀ ਜਿਵੇਂ ਬਰਗਰ ਪੀਜ਼ਾ ਪਰ ਜੋ ਤੁਹਾਡਾ ਪਾਰਸਲ ਦੇਣ ਆਇਆ ਸੀ ਉਹ ਮੈਨੂੰ ਇਹਨਾਂ ਚੀਜ਼ਾਂ ਦੀ ਜਗ੍ਹਾ 'ਤੇ ਪਰੌਂਠੇ ਗੋਲਗੱਪੇ ਦੇ ਗਿਆ ਹੁਣ ਮੈਂ ਛੋਟੀ ਜਿਹੀ ਆਪਣੇ ਘਰ ਦੇ ਵਿੱਚ ਪਾਰਟੀ ਅਰੇਂਜ ਕੀਤੀ ਆ ਮੇਰੇ ਸਾਰੇ ਫਰੈਂਡਸ ਆ ਕੇ ਬੈਠੇ ਹੋਏ ਆ ਜੇ ਤੁਹਾਡੇ ਜਿਹੜਾ ਪਾਰਸਲ ਦੇਣ ਆਇਆ ਸੀ ਉਹਦੇ ਵਿਰੁੱਧ ਮੈਂ ਤੁਹਾਨੂੰ ਤੁਰੰਤ ਹੀ ਦੱਸ ਦਿੱਤਾ ਵਾ ਜੇ ਉਹ ਇੱਦਾਂ ਦੀਆਂ ਚੀਜ਼ਾਂ ਗਲਤ ਐਡਰੈੱਸ 'ਤੇ ਪਹੁੰਚਾ ਕੇ ਜਾਵੇਗਾ ਤਾਂ ਘਰ ਘਰ ਜਾ ਕੇ ਲੈਣ ਵਾਲਿਆਂ ਨੂੰ ਵੀ ਅਤੇ ਜਿਨ੍ਹਾਂ ਦੇ ਘਰ ਪਾਰਸਲ ਦੇ ਗਏ ਉਹਨਾਂ ਨੂੰ ਵੀ ਤੰਗੀ ਆਵੇਗੀ ਸੋ ਤੁਸੀਂ ਜਦੋਂ ਵੀ ਆਪਣੀ ਸ਼ੋਪ ਤੋਂ ਕੋਈ ਵੀ ਪਾਰਸਲ ਭੇਜਦੇ ਹੋ ਤਾਂ ਪਲੀਸ ਉਹਨੂੰ ਚੈੱਕ ਕਰਕੇ ਭੇਜਿਆ ਕਰੋ ਜਾਂ ਤਾਂ ਜੋ ਉਹਨਾਂ ਦਾ ਵੀ ਸਮਾਂ ਬਚੇ ਅਤੇ ਜਿਨ੍ਹਾਂ ਨੇ ਸਮਾਨ ਮੰਗਵਾਇਆ ਵਾ ਉਹਨਾਂ ਦੇ ਵੀ ਸਮੇਂ ਦੀ ਬਚਤ ਹੋਵੇ ਭਾਅ ਜੀ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਅਤੇ ਜਿਹੜੀਆਂ ਚੀਜ਼ਾਂ ਵਾ ਉਹ ਠੀਕ ਠਾਕ ਇੱਕ ਦੂਜੇ ਦੀ ਥਾਂ 'ਤੇ ਪਹੁੰਚਾਇਆ ਕਰੋ